ਅੱਜ ਜਿਹੜੇ ਭਾਰਤ ਵਿੱਚ ਨਾ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਚੁਣੌਤੀਆਂ ਚੱਲ ਰਹੀਆਂ ਉਹ ਹੈਗੀ ਇੱਕ ਤਾਂ ਪੜ੍ਹਾਈ ਦੀ ਸ਼ਿਕਸ਼ਾ ਦੀ ਠੀਕ ਹੈ ਦੂਜੀ ਹੈਗੀ ਹੈ ਕਿ ਸਵੱਸਥ ਦੀ ਬਿਮਾਰੀਆਂ ਹੀ ਲੱਗਦੀਆਂ ਰਹਿੰਦੀਆਂ ਕਦੇ ਕਿਹੜੀ ਬਿਮਾਰੀ ਆ ਗਈ ਕਦੇ ਕਿਹੜੀ ਬਿਮਾਰੀ ਆ ਗਈ ਅਤੇ ਤੀਜੀ ਹੈਗੀ ਮੇਨ ਰੁਜ਼ਗਾਰ ਦੀ ਕੰਮ ਹੋਏਗਾ ਬੰਦੇ ਕੋਲ਼ ਖਾਏਗਾ ਪੀਏਗਾ ਸਹੀ ਤਰੀਕੇ ਨਾਲ ਤਾਹੀਂ ਆਪਣੇ ਆਪ ਨੂੰ ਸਵੱਸਥ ਰੱਖ ਸਕੇਗਾ ਔਰ ਜੇ ਉਹਨੂੰ ਪਤਾ ਹੋਏਗਾ ਕਿ ਕਿਹੜੀ ਚੀਜ਼ਾਂ ਨਾਲ ਉਹਨੂੰ ਬਿਮਾਰੀਆਂ ਲੱਗਦੀਆਂ ਕਿਵੇਂ ਉਹ ਬਚ ਸਕਦਾ ਅਤੇ ਪੜ੍ਹਾਈ ਜੇ ਉਹਨੂੰ ਆਉਂਦੀ ਹੋਵੇਗੀ ਤਾਂ ਹੀ ਕਰੇਗਾ ਹੁਣ ਸਰਕਾਰ ਨੇ ਇਸ ਬਾਰੇ ਬੜਾ ਅੱਛਾ ਕਦਮ ਚੁੱਕਿਆ ਹੋਇਆ ਸਰਕਾਰ ਨੇ ਹੁਣ ਕੀ ਕੀਤਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਹੋਰ ਜ਼ਿਆਦਾ ਅੱਗੇ ਵਾਧਾ ਕਰ ਤਾ ਉਨ੍ਹਾਂ ਨੂੰ ਨਾ ਉਨ੍ਹਾਂ ਨੇ ਸਮਾਟ ਸਕੂਲ ਬਣਾ ਤਾ ਸਰਕਾਰੀ ਸਕੂਲ 'ਚ ਇੱਕ ਤਾਂ ਸਰਕਾਰ ਨੇ ਪਹਿਲਾਂ ਹੀ ਬੱਚਿਆਂ ਨੂੰ ਫ੍ਰੀ ਦੇ ਵਿੱਚ ਬਿਨਾਂ ਪੈਸਿਆਂ ਤੋਂ ਪੜ੍ਹਾ ਰਹੇ ਆ ਉਨ੍ਹਾਂ ਨੂੰ ਉੱਪਰੋਂ ਹੁਣ ਪੜ੍ਹਾਈ ਵੀ ਇੰਨੀ ਵਧੀਆ ਦੇ ਰਹੇ ਉਨ੍ਹਾ ਉੱਥੇ ਕੰਪਿਊਟਰ ਲਿਆਏ ਐਡਵਾਂਸ ਸਾਰੀ ਟੈਕਨੋਲਜੀ ਲਿਆ ਤੀ ਅਤੇ ਬੱਚੇ ਉੱਥੇ ਪੜ੍ਹ ਰਹੇ ਹੈ ਸਮਝ ਰਹੇ ਆਪਣੇ ਆਪ ਦੀ ਜਿਹੜਾ ਉਨ੍ਹਾਂ ਦਾ ਗਿਆਨ ਹੈ ਉਹਦੇ 'ਚ ਵਾਧਾ ਕਰਦੇ ਪਏ ਆ ਉਹ ਸੋਚਦੇ ਪਏ ਹੈ ਕਿ ਇੰਨੇ ਵਧੀਆ ਤਰੀਕੇ ਨਾਲ ਉਹਨੂੰ ਪੜ੍ਹਾ ਰਹੇ ਅਤੇ ਹੁਣ ਬਿਮਾਰੀਆਂ ਵਾਸਤੇ ਤਾਂ ਸਰਕਾਰ ਨੇ ਸਰਕਾਰੀ ਸਕੂ ਉੱਥੇ ਹੋਸਪੀਟਲ ਸਾਰੇ ਖੋਲ਼੍ਹੇ ਹੋਏ ਐਂ ਅਤੇ ਉਸ ਹੋਸਪੀਟਲਾਂ ਦੇ ਵਿੱਚ ਵੀ ਜਿਹੜੀ ਨਰਸਾਂ ਰੱਖੀਆਂ ਘਰ ਘਰ ਜਾ ਕੇ ਟਾਈਮ ਟਾਈਮ 'ਤੇ ਅਲੱਗ ਅਲੱਗ ਬਿਮਾਰੀਆਂ ਬਾਰੇ ਦੱਸਦੇ ਇਹ ਵੀ ਦੱਸਦੇ ਕਿ ਕਿਹੜਾ ਟੀਕਾ ਕਿਸ ਟਾਈਮ 'ਤੇ ਲਾਈਏ ਕਿਸ ਬਿਮਾਰੀ ਤੋਂ ਅਸੀਂ ਬਚ ਸਕਦੇ ਹਾਂ ਸਰਕਾਰ ਛੋਟੇ ਬੱਚਿਆਂ ਨੂੰ ਵੀ ਪੰਜ ਸਾਲ ਤੱਕ ਦਸ ਸਾਲ ਤੱਕ ਟੀਕੇ ਫ੍ਰੀ ਲਗਾਉਂਦੀ ਹੈ ਜਿਹੜੇ ਕਿ ਉਨ੍ਹਾਂ ਨੂੰ ਸਰਕਾਰੀ ਹੋਸਪੀਟਲ ਵੱਲੋਂ ਹੀ ਦਿੱਤੇ ਜਾਂਦੇ ਹੈ ਅਤੇ ਹੁਣ ਆਈ ਗੱਲ ਨੌਕਰੀਆਂ ਦੀ ਅਤੇ ਨੌਕਰੀਆਂ ਵਾਸਤੇ ਵੀ ਸਰਕਾਰ ਨੇ ਰੁਜ਼ਗਾਰ ਵਾਸਤੇ ਵੀ ਬੜਾ ਕਦਮ ਚੁੱਕੇ ਹੋਏ ਹੈ ਹਰ ਜਗ੍ਹਾ 'ਤੇ ਸਰਕਾਰ ਨੇ ਨੌਕਰੀਆਂ ਵਾਸਤੇ ਇਹ ਇਹ ਕਿਹਾ ਹੋਇਆ ਕਿ ਜੇ ਬੰਦਾ ਪੜ੍ਹਦਾ ਹੈ ਲਿਖਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਚੰਗੀ ਜਗ੍ਹਾ 'ਤੇ ਨੌਕਰੀ 'ਤੇ ਲਗਾਇਆ ਜਾਏਗਾ ਔਰ ਇਹ ਪੜ੍ਹ ਲਿਖ ਕੇ ਹੀ ਹੋਏਗਾ ਅਤੇ ਉਹ ਪੜ੍ਹਿਆ ਲਿਖਿਆ ਜਾਏਗਾ ਸਰਕਾਰ ਦੀ ਮਿਹਨਤ ਦੇ ਨਾਲ ਤਾਂ ਇਸ ਤਰੀਕੇ ਨਾਲ ਸਰਕਾਰ ਹੁਣ ਸਾਡਾ ਸਹਿਯੋਗ ਦੇ ਰਹੀ ਹੈ